ਮੈਂ ਆਪਣੇ ਸੰਗ੍ਰਹਿ ਲਈ ਨਵੀਂ ਆਈਟਮ ਗੂਗਲ ਤੋਂ ਓਨਲਾਈਨ ਜਾ ਕੇ ਖਰੀਦ ਲੈਂਦੀ ਹਾਂ ਜਿਵੇਂ ਫਲਿਪ ਕਾਰਟ ਹੋ ਗਿਆ ਐਮਾਜ਼ੋਨ ਹੋ ਗਿਆ ਮਿੰਤਰਾ ਹੋ ਗਿਆ ਉੱਥੇ ਜਾ ਕੇ ਮੈਂ ਆਪਦੀ ਓਨਲਾਈਨ ਖਰੀਦਦਾਰੀ ਕਰਦੀ ਹਾਂ ਕਿਉਂਕਿ ਮੈਨੂੰ ਓਨਲਾਈਨ ਖਰੀਦਣ ਦਾ ਬਹੁਤ ਸ਼ੌਕ ਹੈ ਜਿਵੇਂ ਮੈਂ ਆਪਣੇ ਸੂਟ ਮੰਗਾਉਂਦੀ ਰਹਿੰਦੀ ਹਾਂ ਘਰ ਵਰਤੋਂ ਦੀ ਚੀਜ਼ਾਂ ਬਨਾਨੀ ਹਾਂ ਉਹ ਸਾਈਟ 'ਤੇ ਜਾ ਕੇ ਜਿਵੇਂ ਮੈਂ ਐਮਾਜੋਨ ਦੀ ਸਾਈਟ 'ਤੇ ਜਾਣਾ ਉੱਥੇ ਜਾ ਕੇ ਚੀਜ਼ਾਂ ਪਹਿਲਾਂ ਤਾਂ ਉੱਥੇ ਸਰਚ ਦੀ ਓਪਸ਼ਨ ਆਉਂਦੀ ਹੈ ਸਰਚ ਦੀ ਓਪਸ਼ਨ 'ਚ ਮੈਂ ਜਿਹੜੀ ਚੀਜ਼ ਲੈਣੀ ਹੁੰਦੀ ਮੰਨ ਲਓ ਮੈਂ ਕੋਈ ਕਿਚਨ ਦੀ ਅਸੈਸਰੀ ਲੈਣੀ ਹੈ ਜਾਂ ਆਪਦੇ ਸੂਟਸ ਲੈਣੇ ਹੈ ਕੁੜਤੀਜ਼ ਲੈਣੀ ਹੈ ਉਹ ਮੈਂ ਉੱਥੇ ਜਾ ਕੇ ਪਹਿਲਾਂ ਸਲੈਕਟ ਕਰਦੀ ਐ ਉਸ ਤੋਂ ਬਾਅਦ ਉਹ ਰੇਂਜ ਪੁੱਛਦੇ ਐ ਕਿਸ ਰੇਂਜ ਦੀ ਲੈਣੀ ਹੈ ਅਤੇ ਉਸ ਤੋਂ ਬਾਅਦ ਮੈਂ ਉਹਦੇ 'ਚ ਰੇਂਜ ਸਲੈਕਟ ਕਰ ਲੈਂਦੀ ਹਾਂ ਕਿੰਨੇ ਪੈਸੇ ਦੀ ਲੈਣੀ ਹੈ ਉਸ ਤੋਂ ਬਾਅਦ ਸਾਰੀਆਂ ਓਪਸ਼ਨ ਆ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਮੈਂ ਸਲੈਕਟ ਕਰਦੇ ਹਾਂ ਜਿਹੜੀ ਜਿਹੜੀ ਮੈਨੂੰ ਕਰਨੀ ਚਾਹੀਦੀ ਐਡ ਟੂ ਕਾਰਟ ਕਰਨੀ ਹੈ ਐਡ ਟੂ ਕਾਰਟ ਵਿੱਚ ਜਿੰਨੀਆਂ ਮੰਨ ਲਓ ਮੈਂ ਦਸ ਕੁੜਤੀਆਂ ਸਲੈਕਟ ਕੀਤੀਆਂ ਉਹਦੇ ਵਿੱਚੋਂ ਸੌ ਕੁੜਤੀਆਂ ਵਿੱਚੋਂ ਦਸ 'ਚੋਂ ਫਿਰ ਮੈਂ ਜਿਹੜੀਆਂ ਦੋ ਜਾਂ ਤਿੰਨ ਲੈਂਦੀ ਹਾਂ ਉਹਨੂੰ ਸਲੈਕਟ ਕਰ ਲਿਆ ਉਹ ਅਪ ਮੇਰੀ ਮਰਜ਼ੀ ਕਈ ਵਾਰ ਮੈਂ ਇੱਕ ਵੀ ਲੈ ਲੈਂਦੀ ਹਾਂ ਉਹਦੇ ਵਿੱਚੋਂ ਸਲੈਕਟ ਕਰਕੇ ਉਸ ਤੋਂ ਬਾਅਦ ਉਹ ਮੇਰਾ ਪੈਸੇ ਪੁੱਛਦਾ ਕੁਆਂਟਿਟੀ ਪੁੱਛਦਾ ਵੀ ਇੱਕ ਲੈਣੀ ਹੈ ਦੋ ਲੈਣੀ ਹੈ ਸਾਈਜ਼ ਪੁੱਛਦਾ ਸਾਈਜ਼ ਤੋਂ ਬਾਅਦ ਉਹ ਮੇਰਾ ਪੈਸੇ ਪੁੱਛਦਾ ਵੀ ਤੁਸੀਂ ਓਨਲਾਈਨ ਪੇਮੈਂਟ ਕਰਨੀ ਹੈ ਜਾਂ ਕੈਸ਼ ਓਨ ਡਿਲੀਵਰੀ ਕਰਨੀ ਹੈ ਉਸ ਤੋਂ ਬਾਅਦ ਮੈਂ ਆਪਣਾ ਐਡਰੈਸ ਪਾ ਦਿੰਦੀ ਹਾਂ ਉਸ ਤੋਂ ਬਾਅਦ ਮੈਂ ਸਬਮਿਟ ਕਰ ਦਿੰਦੀ ਹਾਂ ਕਈ ਵਾਰ ਮੈਂ ਹੋਰ ਵੀ ਕਈ ਵਾਰ ਮੈਂ ਬਾਜ਼ਾਰ ਜਾ ਕੇ ਵੀ ਸ਼ੋਪਿੰਗ ਕਰ ਲੈਂਦੀ ਹਾਂ ਕਈ ਜਿੱਥੇ ਮੇਰੀ ਜਾਣ ਪਹਿਚਾਣ ਦੀ ਦੁਕਾਨ ਹੈ ਜਿੱਥੋਂ ਮੈਨੂੰ ਪਤਾ ਸਹੀ ਰੇਟ 'ਤੇ ਸਹੀ ਚੀਜ਼ ਮਿਲੇਗੀ ਉੱਥੇ ਵੀ ਮੈਂ ਕਈ ਵਾਰ ਕੁਲੈਕਟਰਾਂ 'ਤੇ ਜਾ ਕੇ ਆਪ ਵਪਾਰ ਕਰਕੇ ਵਪਾਰ ਕਰਦੀ ਐ ਅਤੇ ਆਪਦੀ ਮਰਜ਼ੀ ਦੀਆਂ ਚੀਜ਼ਾਂ ਲੈਂਦੀ ਹਾਂ ਉੱਥੇ ਜਾ ਕੇ ਕੈਸ਼ ਓਨ ਡਿਲੀਵਰੀ ਵੀ ਕਈ ਵਾਰ ਕਰ ਲੈਂਦੀ ਹਾਂ ਕਈ ਵਾਰ ਆਪਦੀ ਮੈਂ ਕਾਰਡ ਪੇਮੈਂਟ ਵੀ ਕਰ ਲੈਂਦੀ ਹਾਂ ਜਿਸ ਤਰ੍ਹਾਂ ਮੈਨੂੰ ਠੀਕ ਲਗਦਾ ਅਤੇ ਆਪਣੀ ਤਰ੍ਹਾਂ ਤਰ੍ਹਾਂ ਦੀ ਕੋਲੈਕਸ਼ਨ ਮੈਨੂੰ ਸ਼ੌਕ ਹੈ ਕਰਨ ਦਾ ਮੈਂ ਕਰਦੀ ਰਹਿੰਦੀ